ਟੈਕਨਾਲੂਜੀ ਇੱਕੀਵੀਂ ਸਦੀ ਦਾ ਸਭ ਤੋਂ ਵੱਡਾ ਵਰਦਾਨ ਹੈ ਇਸ ਨੇ ਹਰ ਇਨਸਾਨ ਦੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਟੈਕਨਾਲੋਜੀ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਸੋਚ ਵੀ ਨਹੀਂ ਸਕਦੇ ਟੈਕਨੋਲੋਜੀ ਦੇ ਕਾਰਨ ਘਰ ਬੈਠੇ ਹੀ ਅਸੀਂ ਸਾਰੇ ਕੰਮ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ ਜਿਵੇਂ ਕਿ ਕਿਤੇ ਵੀ ਟਿਕਟ ਬੁੱਕ ਕਰਨਾ ਕਿਸੇ ਟ੍ਰੇਨ ਦੀ ਕਿਸੇ ਪਲੇਨ ਦੀ ਟਿਕਟ ਬੁੱਕ ਕਰਨਾ ਬਹੁਤ ਹੀ ਸੌਖਾ ਹੈ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਅਸੀਂ ਆਪਣੇ ਮੋਬਾਈਲ ਲੈਪਟੋਪ ਜਾਂ ਕੰਪਿਊਟਰ ਤੋਂ ਕਿਤੇ ਦੀ ਵੀ ਬੁਕਿੰਗ ਕਰ ਸਕਦੇ ਹਾਂ ਇਸ ਤੋਂ ਇਲਾਵਾ ਬੈਂਕਿੰਗ ਦੀਆਂ ਸੇਵਾਵਾਂ ਵੀ ਸਾਡੇ ਫੋਨ 'ਤੇ ਹੀ ਉਪਲਬਧ ਹਨ ਅਸੀਂ ਕਿਤੇ ਵੀ ਕੋਈ ਵੀ ਪੈਸਾ ਭੇਜ ਜਾਂ ਲੈ ਸਕਦੇ ਹਾਂ ਔਨਲਾਈਨ ਖਰੀਦਦਾਰੀ ਕਰ ਸਕਦੇ ਹਾਂ ਅੱਜ ਕੱਲ੍ਹ ਵੱਖੋ ਵੱਖਰੀਆਂ ਸਾਈਟਸ ਉੱਤੇ ਬਹੁਤ ਸਾਰੇ ਇਲੈਕਟਰੋਨਿਕਸ ਕੱਪੜੇ ਖੇਡਾਂ ਦਾ ਸਮਾਨ ਅਤੇ ਹੋਰ ਘਰ ਦੇ ਸਮਾਨ ਦੀ ਸ਼ੋਪਿੰਗ ਆਦਿ ਔਨਲਾਈਨ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਸਾਡਾ ਸਮਾਂ ਵੀ ਬਚਦਾ ਹੈ ਅਤੇ ਸਾਨੂੰ ਮਹਿੰਗੇ ਦਾਮ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਅਸੀਂ ਕਿਸੇ ਵੀ ਸਰਚ ਇੰਜਣ ਜਿਵੇਂ ਗੂਗਲ ਆਦਿ ਰਾਹੀਂ ਕਿਸੇ ਦੁਨੀਆ ਦੇ ਕਿਸੇ ਵੀ ਕੋਨੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਘਰ ਬੈਠੇ ਦੁਨੀਆ ਵਿੱਚ ਹੋ ਰਹੀਆਂ ਵੱਖੋ ਵੱਖ ਗਤ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਤੇ ਦੁਨੀਆ ਵਿੱਚ ਹੋ ਰਹੇ ਪ੍ਰਗਤੀ ਬਾਰੇ ਵੀ ਸਾਨੂੰ ਜਾਗਰੂਕਤਾ ਮਿਲਦੀ ਹੈ ਇਸ ਲਈ ਤਕਨੋਲੋਜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਉਂਦੀ ਹੈ